ਮੇਰੇ ਮਨਪਸੰਦ ਸਿਲਾਈ ਸੂਟ ਮੇਰੇ ਮਨਪਸੰਦ ਸਿਲਾਈ ਸੂਟ ਹੈ ਨਾ ਅਤੇ ਪਠਾਣੀ ਸੂਟ ਵੀ ਹਨ ਇਹਨਾਂ ਦੀ ਵੀਡੀਓ ਮੈਂ ਯੂਟੀਊਬ 'ਤੇ ਪਾ ਦਿੰਦੀ ਹਾਂ ਅਤੇ ਉਹਨਾਂ ਨੂੰ ਉਹਨਾਂ ਦੀ ਮੈਸੇਜ ਮੈਨੂੰ ਯੂਟੀਊਬ 'ਤੇ ਆ ਜਾਂਦੇ ਹਨ 'ਤੇ ਮੈਂ ਉਹਨਾਂ ਨੂੰ ਸੂਟਾਂ ਬਾਰੇ ਜਾਣਕਾਰੀ ਦੇ ਦਿੰਦੀ ਹਾਂ ਅਤੇ ਆਪਣੇ ਆਪਣੀ ਮਸ਼ਹੂਰੀ ਆਪਣੇ ਹੁਨਰ ਦੀ ਮਸ਼ਹੂਰੀ ਕਰਦੀ ਹਾਂ ਜਿਸ ਨਾਲ ਕਿ ਉਹਨਾਂ ਨੂੰ ਮੇਰੇ ਸੀਤੇ ਹੋਏ ਕਈ ਡਿਜ਼ਾਈਨਰ ਸੂਟ ਬਹੁਤ ਹੀ ਪਸੰਦ ਆਉਂਦੇ ਹਨ ਅਤੇ ਉਹ ਬਾਰ ਬਾਰ ਮੈਨੂੰ ਫੋਨ ਕਰਕੇ ਪੁੱਛਦੇ ਰਹਿੰਦੇ ਹਨ